ਬਾਰਾਂ ਮਾਰਚ ਉੱਨੀ ਨੜਿੱਨਵੇ ਸੱਤ ਅਪ੍ਰੈਲ ਵੀਹ ਬਾਰਾਂ ਵੀਹ ਜਨਵਰੀ ਵੀਹ ਤੇਰਾਂ ਉੱਨੀ ਨਵੰਬਰ ਵੀਹ ਸਤਾਰਾਂ ਵੀਹ ਦਸੰਬਰ ਵੀਹ ਇੱਕੀ